ਸੱਭਿਆਚਾਰ ਦਾ ਸੰਬੰਧ ਕਿਸੇ ਸਮੁੱਚੇ ਜਨ ਸਮੂਹ ਜਾਂ ਭੂਗੋਲਿਕ ਖੇਤਰ ਨਾਲ ਹੁੰਦਾ ਹੈ ਪਰੰਤੂ ਇਸ ਵਿੱਚ ਮੌਜੂਦ ਤਰ੍ਹਾਂ ਤਰ੍ਹਾਂ ਦੇ ਲੋਕ ਆਪਸ ਵਿੱਚ ਇੱਕ ਦੂਸਰੇ ਨੂੰ ਅਲੱਗ ਕਰਦੇ ਹਨ ਜਿਵੇਂ ਕਿ ਉਹਨਾਂ ਦੀਆਂ ਭਾਸ਼ਾਵਾਂ ਬੋਲਣ ਦਾ ਤਰੀਕਾ ਰਹਿਣ ਸਹਿਣ ਅਤੇ ਹੋਰ ਉਹਨਾਂ ਨੂੰ ਇੱਕ ਦੂਸਰੇ ਤੋਂ ਅਲੱਗ ਕਰਦੇ ਹਨ ਜਿਸਨੂੰ ਉੱਭ ਸੱਭਿ ਉੱਪ ਸੱਭਿਆਚਾਰ ਮੰਨਿਆ ਜਾਂਦਾ ਹੈ ਉਦਾਹਰਨ ਦੇ ਤੌਰ 'ਤੇ ਜੇਕਰ ਭਾਰਤੀ ਸੱਭਿਆਚਾਰ ਨੂੰ ਦੇਖਿਆ ਜਾਵੇ ਤਾਂ ਮਰਾਠੀ ਅਤੇ ਬੰਗਾਲੀ ਇਸਦੇ ਉੱਪ ਸੱਭਿਆਚਾਰ ਹਨ ਪਰੰਤੂ ਇਹ ਆਪਣੇ ਆਪਣੇ ਵਿੱਚ ਇੱਕ ਭੂਗੋਲਿਕ ਖੇਤਰਾਂ ਵਿੱਚ ਮੂਲ ਸੱਭਿਆਚਾਰ ਹਨ ਇਸ ਪ੍ਰਕਾਰ ਜਿੱਥੇ ਪੰਜਾਬ ਦਾ ਆਪਣਾ ਸੱਭਿਆਚਾਰ ਹੈ ਉੱਥੇ ਮਾਝੀ ਦੁਆਬੀ ਆਦਿ ਇਸਦੇ ਉੱਪ ਸੱਭਿਆਚਾਰ ਹਨ ਅਤੇ ਇਸ ਵਿੱਚ ਵੱਖ ਵੱਖ ਜਾਤਾਂ ਕੀਤੀਆਂ ਧਰਮਾਂ ਅਤੇ ਉੱਪ ਸੱਭਿਆਚਾਰ ਮੌਜੂਦ ਹਨ ਪੰਜਾਬ ਖੇਡਾਂ ਤਿਉਹਾਰਾਂ ਮੇਲਿਆਂ ਕਰਕੇ ਹੀ ਪਛਾਣਿਆ ਜਾਂਦਾ ਹੈ ਇੱਥੋਂ ਦੇ ਲੋਕ ਇਸ ਸਭ ਨੂੰ ਕਾਇਮ ਰੱਖਣ ਲਈ ਬਹੁਤ ਕੁਝ ਕਰਦੇ ਹਨ ਇਹੀ ਕਾਰਨ ਹੈ ਕਿ ਇਹ ਸਭ ਅਜੇ ਤੱਕ ਵੀ ਚੱਲਦਾ ਆ ਰਿਹਾ ਹੈ ਅਤੇ ਲੋਕਾਂ ਨੇ ਅਜੇ ਤੱਕ ਵੀ ਪੰਜਾਬੀ ਸੱਭਿਆਚਾਰ ਨੂੰ ਕਾਇਮ ਰੱਖਿਆ ਹੋਇਆ ਹੈ